ਪੰਜਾਬ ਦੇ ਖੇਤੀਬਾੜੀ ਖੇਤਰ ਵਿੱਚ ਬਹੁਤ ਸਾਰੇ ਕਾਰੋਬਾਰੀ ਮੌਕੇ ਜਿਹੜੇ ਆ ਉਹ ਉੱਭਰ ਰਹੇ ਆ ਸਭ ਤੋਂ ਪਹਿਲਾਂ ਤਾਂ ਜਿਹੜੇ ਕਿਸਾਨ ਨੇ ਉਹ ਜੈਵਿਕ ਖੇਤੀ ਨੂੰ ਤਰਜੀਹ ਦਿੰਦੇ ਆ ਕਿਉਂਕਿ ਅੱਜ ਕੱਲ੍ਹ ਕੈਮੀਕਲ ਯੁਕਤ ਅਨਾਜ ਖਾਣਾ ਫਸਲਾਂ ਖਾਣਾ ਕੋਈ ਪਸੰਦ ਨਹੀਂ ਕਰਦਾ ਸਾਰੇ ਚਾਹੁੰਦੇ ਆ ਕਿ ਉਹਨਾਂ ਨੂੰ ਸ਼ੁੱਧ ਅਤੇ ਦੇਸੀ ਆਹਾਰ ਮਿਲੇ ਇਸ ਕਰਕੇ ਜੈਵਿਕ ਖੇਤੀ ਦਾ ਰੁਝਾਨ ਬਹੁਤ ਵੱਧ ਰਿਹਾ ਹੈ ਅਤੇ ਇਹਦੇ ਵਿੱਚ ਨਿਵੇਸ਼ ਕਰਨਾ ਫਾਇਦੇ ਦਾ ਸੌਦਾ ਹੋਵੇਗਾ ਅਤੇ ਦੂਸਰੀ ਗੱਲ ਜੋ ਮੈਂ ਕਹਿਣਾ ਚਾਹੁੰਦੀ ਆ ਉਹ ਇਹ ਹੈ ਕਿ ਆਪਾਂ ਟੈਕਨੋਲੋਜੀ ਜੋ ਸਾਡੀ ਨਵੀਂ ਟੈਕਨੋਲਜੀ ਹੈ ਖੇਤੀਬਾੜੀ ਨਾਲ ਸੰਬੰਧਿਤ ਜੇ ਅਸੀਂ ਉਹਦੇ ਵਿੱਚ ਵੀ ਨਿਵੇਸ਼ ਕਰੀਏ ਤਾਂ ਸਾਨੂੰ ਬਹੁਤ ਜ਼ਿਆਦਾ ਫਾਇਦਾ ਹੋ ਸਕਦਾ ਏ ਇਸ ਤਰ੍ਹਾਂ ਹੋਰ ਵੀ ਬਹੁਤ ਸਾਰੇ ਤਰੀਕੇ ਨੇ ਜੋ ਕਿ ਪੰਜਾਬ ਦੀ ਖੇਤੀਬਾੜੀ ਖੇਤਰ ਵਿੱਚ ਉੱਭਰ ਰਹੇ ਆ ਅਤੇ ਕਿਸਾਨ ਅਗਰ ਇਸ ਦੇ ਵਿੱਚ ਨਿਵੇਸ਼ ਕਰਨ ਤਾਂ ਉਹ ਫਾਇਦੇ ਦਾ ਸੌਦਾ ਹੋਵੇਗਾ